ਮੈਨੂੰ ਦੁਨੀਆ ਵਿੱ ਮੈਨੂੰ ਡਾਂਸਿੰਗ ਦਾ ਬਹੁਤ ਸ਼ੌਕ ਹੈ ਮੈਂ ਡਾਂਸਿੰਗ ਕਰਨਾ ਬਹੁਤ ਪਸੰਦ ਕਰਦੀ ਹਾਂ ਮੈਂ ਭੰਗੜੇ ਅਤੇ ਗਿੱਧੇ ਵਿੱਚ ਕੋਲਜ ਟਾਈਮ ਵਿੱਚ ਪਾਰਟੀਸਪੇਟ ਸਕੂਲ ਟਾਈਮ ਵਿੱਚ ਪਾਰਟੀਸਪੇਟ ਕਰਦੀ ਰਹੀ ਹਾਂ ਮੈਂ ਡਾਂਸ ਲੀਏ ਘਰੇ ਇੱਕ ਰੂਮ ਤਿਆਰ ਕੀਤਾ ਹੋਇਆ ਹੈ ਜਿੱਥੇ ਮੈਂ ਬੱਚਿਆਂ ਨੂੰ ਡਾਂਸ ਭੰਗੜਾ ਸਿਖਾਉਂਦੀ ਹਾਂ ਮੈਨੂੰ ਇਹ ਬਹੁਤ ਸ਼ੌਕ ਹੈ ਕਿ ਮੈਂ ਡਾਂਸ ਕਰਾਂ ਅਤੇ ਡਾਂਸ ਸਿੱਖਾਂ ਅਤੇ ਦੂਸਰਿਆਂ ਨੂੰ ਵੀ ਸਿੱਖਾਵਾਂ ਮੈਨੂੰ ਖਾਣ ਪੀਣ ਦਾ ਵੀ ਬਹੁਤ ਸ਼ੌਕ ਹੈ ਮੈਂ ਕੁਕਿੰਗ ਕਰਨੀ ਬਹੁਤ ਪਸੰਦ ਕਰਦੀ ਹਾਂ ਮੈਂ ਰਸੋਈ ਵਿੱਚ ਜਦ ਵੀ ਮੇਰਾ ਮਨ ਕਰੇ ਨਵੀਆਂ ਨਵੀਆਂ ਡਿਸ਼ਾਂ ਬਣਾਉਣੀਆਂ ਸਿੱਖਦੀ ਰਹਿੰਦੀ ਹਾਂ ਮੰਨਚੂਰੀਅਨ ਜਿਵੇਂ ਕਿ ਪਾਸਤਾ ਬਣਾ ਲਿਆ ਮੰਚੂਰੀਅਨ ਬਣਾ ਲਿਆ ਇੱਦਾਂ ਹੀ ਮੈਂ ਘਰ ਵਿੱਚ ਬੱਚਿਆਂ ਲਈ ਇਹ ਅਲੱਗ ਅਲੱਗ ਤਰ੍ਹਾਂ ਦੇ ਟਿਫਨ ਇਹਨਾਂ ਲਈ ਅਲੱਗ ਅਲੱਗ ਤਰ੍ਹਾਂ ਦੇ ਟਿਫਨ ਖਾਣ ਲਈ ਨਮਕੀਨ ਮਿੱਠਾ ਵਗੈਰਾ ਹਰ ਰੋਜ਼ ਨਵਾਂ ਨਵਾਂ ਟਰਾਈ ਕਰਦੀ ਰਹਿੰਦੀ ਹਾਂ ਕੁਕਿੰਗ ਮੇਰਾ ਬਹੁਤ ਵੱਡਾ ਸ਼ੌਕ ਹੈ ਇਸਨੂੰ ਮੈਂ ਹਮੇਸ਼ਾ ਇੱਦਾਂ ਹੀ ਰੱਖਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਮੈਂ ਕੁਕਿੰਗ ਇੱਦਾਂ ਹੀ ਕਰਦੀ ਰਹਾਂ ਅਤੇ ਮੇਰੇ ਘਰਦਿਆਂ ਨੂੰ ਮੇਰਾ ਬਣਾਇਆ ਹੋਇਆ ਖਾਣਾ ਰੋਟੀ ਸਬਜ਼ੀ ਜੋ ਵੀ ਹੈ ਇੱਦਾਂ ਹੀ ਪਸੰਦ ਆਉਂਦਾ ਰਹੇ ਇਸ ਸ਼ੌਕ ਨੂੰ ਇੱਦਾਂ ਹੀ ਉਹ ਬਣਾਈ ਰੱਖਾਂ ਖਾਣਾ ਬਣਾਉਣਾ ਅਤੇ ਡਾਂਸ ਕਰਨਾ ਮੇਰਾ ਬਹੁਤ ਵੱਡਾ ਸ਼ੌਕ ਹੈ